ਮੈਂ ਚਿੱਤਰਕਾਰੀ ਕਰਦੇ ਸਮੇਂ ਕੋਈ ਖਾਸ ਕਿਸਮ ਦੀ ਸਿਲ ਸ਼ਿਪਲਾਈ ਦੀ ਵਰਤੋਂ ਨਹੀਂ ਕਰਦੀ ਹਾਂ ਮੈਂ ਆਮ ਜੋ ਰੋਜ਼ਾਨਾ ਵਿੱਚ ਵਰਤੀ ਜਾਂਦੀ ਹੈ ਪੈਨਸਲ ਰੇਜਰ ਸਕੈੱਚ ਦੀ ਵਰਤੋਂ ਹੀ ਕਰਦੀ ਹਾਂ ਅਤੇ ਮੇਰਾ ਪਸੰਦੀਦਾ ਬਰੈਂਡ ਜੋ ਕੰਫਰਟੇਬਲ ਹੋਵੇ ਜਿੱਦਾਂ ਰੈਡ ਟੇਪ ਹੈ ਅਤੇ ਮੈਂ ਇਸਨੂੰ ਖੰਨੇ ਤੋਂ ਖਰੀਦਦੀ ਹਾਂ ਰੈਡ ਟੇਪ ਅਤੇ ਬਹੁਤ ਹੀ ਵਧੀਆ ਬ੍ਰਾਂਡ ਹੈ ਕਿ ਮੈਨੂੰ ਲੱਗਦਾ ਕਿ ਕਲਾ ਅਤੇ ਸ਼ਿਪ ਸਿਲ ਸ਼ਿਪਲਾਈ ਸਟੇਸ਼ਨਰੀ ਮਹਿੰਗੀ ਵੀ ਨਹੀਂ ਹੈ ਅਤੇ ਸਸਤੀ ਵੀ ਨਹੀਂ ਹੈ ਅਤੇ ਇੱਕ ਮੀਡੀਅਮ ਜਿਹੇ ਤਰੀਕੇ ਨਾਲ ਵਰਤੀ ਜਾਂਦੀ ਅਤੇ ਵਰਤੋਂ ਵਿੱਚ ਆਉਣ ਵਾਲੀ ਸ ਸਟੇਸ਼ਨਰੀ ਹੈ ਜ਼ਿਆਦਾ ਮਹਿੰਗੀਆਂ ਵੀ ਨਹੀਂ ਹਨ